ਜੇਕਰ ਮੈਨੂੰ ਦੁਨੀਆਂ ਵਿੱਚ ਕਿਤੇ ਵੀ ਯਾਤਰਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਸ਼੍ਰੀ ਹੇਮਕੁੰਟ ਸਾਹਿਬ ਜਾਣਾ ਪਸੰਦ ਕਰੂੰਗੀ ਕਿਉਂਕਿ ਇੱਕ ਤਾਂ ਉਹ ਰੀਲੀਜਿਅਸ ਪਲੇਸ ਹੈ ਦੂਸਰਾ ਕਿ ਮੈਂ ਉਸ ਪਲੇਸ 'ਤੇ ਕਦੇ ਗਈ ਨਹੀਂ ਮੈਂ ਉਸ ਪਲੇਸ ਬਾਰੇ ਸੁਣਿਆ ਬਹੁਤ ਹੈ ਮੇਰੇ ਹਸਬੈਂਡ ਜਾ ਚੁੱਕੇ ਹੈ ਉੱਥੇ ਕਈ ਵਾਰ ਬਟ ਹੈਲਥ ਇਸ਼ੂ ਕਰਕੇ ਜਾਂ ਕੁਛ ਵੀ ਕੋਈ ਨਾ ਕੋਈ ਰੀਜ਼ਨ ਇੱਦਾਂ ਦਾ ਹੋ ਜਾਂਦਾ ਸੀਗਾ ਕਿ ਮੈਂ ਨਹੀਂ ਜਾ ਪਾਈ ਪਰ ਜਦੋਂ ਵੀ ਮੈਨੂੰ ਮੌਕਾ ਮਿਲਿਆ ਮੈਂ ਉੱਥੇ ਜ਼ਰੂਰ ਜਾਣਾ ਚਾਹਾਂਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਪ ਤਪ ਸਥਾਨ ਰਿਹਾ ਏ ਉਹ ਜਦੋਂ ਵੀ ਮੌਕਾ ਮਿਲਿਆ ਮੈਂ ਉੱਥੇ ਹੀ ਜਾਊਂਗੀ